ਮੇਰੇ ਘਰ ਦੀ ਰਸੋਈ ਦੇ ਵਿੱਚ ਕੌਲੀਆਂ ਚਮਚੇ ਗਲਾਸ ਬਾਟੀਆਂ ਥਾਲੀਆਂ ਪਲੇਟਾਂ ਪਤੀਲੇ ਬਾਲਟੀਆਂ ਆਦਿ ਹਨ ਅਤੇ ਇਨ੍ਹਾਂ ਦੇ ਵਿੱਚ ਥਾਲੀ ਦੀ ਵਰਤੋਂ ਰੋਟੀ ਰੱਖਣ ਦੇ ਲਈ ਕੌਲੀਆਂ ਦੀ ਵਰਤੋਂ ਸਬਜ਼ੀ ਜਾਂ ਕੋਈ ਮਿੱਠੀ ਚੀਜ਼ ਪਾਉਣ ਦੇ ਲਈ ਚਮਚਿਆਂ ਦੀ ਵਰਤੋਂ ਖਾਣ ਦੇ ਲਈ ਗਲਾਸ ਦੇ ਵਿੱਚ ਕੁਛ ਵੀ ਪੀਣ ਵਾਲਾ ਪਦਾਰਥ ਪਾਉਣ ਦੇ ਲਈ ਪਤੀਲਿਆਂ ਵਿੱਚ ਸਬਜ਼ੀ ਬਣਾਉਣ ਦੇ ਲਈ ਅਤੇ ਬਾਲਟੀਆਂ ਦੇ ਵਿੱਚ ਕੁਛ ਵੀ ਪਾਣੀ ਜਾਂ ਦੁੱਧ ਰੱਖਣ ਦੇ ਲਈ ਕੀਤੀ ਜਾਂਦੀ ਹੈ